ਡਾਂਸ ਡਾਂਸ ਮੈਨੂੰ ਬਹੁਤ ਪਸੰਦ ਹੈ ਮੈਨੂੰ ਡਾਂਸ ਕਰਨਾ ਨਹੀਂ ਆਉਂਦਾ ਸੀ ਅਤੇ ਮੈਨੂੰ ਸੋਸ਼ਲ ਮੀਡੀਆ 'ਤੇ ਡਾਂਸ ਬਾਰੇ ਵੇਖਿਆ ਅਤੇ ਉੱਥੋਂ ਵੀਡੀਓਸ ਦੇਖੀਆਂ ਮੈਂ ਡਾਂਸ ਸਿੱਖਿਆ ਡਾਂਸ ਸਿੱਖ ਮੈਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਕਿਉਂਕਿ ਜਿੱਥੇ ਵੀ ਕਦੇ ਵੀ ਕੋਈ ਫੰਕਸ਼ਨ ਹੁੰਦਾ ਸੀ ਤਾਂ ਮੈਨੂੰ ਨੱਚਣਾ ਨਹੀਂ ਆਉਂਦਾ ਸੀ ਸਾਰੇ ਮੈਨੂੰ ਕਹਿੰਦੇ ਸੀ ਕਿ ਨੱਚ ਨੱਚ ਬਟ ਮੈਨੂੰ ਨੱਚਣਾ ਨਹੀਂ ਆਉਂਦਾ ਸੀਗਾ ਇਸ ਲਈ ਮੈਂ ਹੁਣ ਡਾਂਸ 'ਚ ਇੰਨੀ ਜ਼ਿਆਦਾ ਅੱਗੇ ਵੱਧ ਗਈ ਹਾਂ ਕਿ ਡਾਂਸ਼ ਮੇਰਾ ਪ੍ਰਫੈਸ਼ਨ ਬਣ ਗਿਆ ਹੈ ਹੁਣ ਜਿੱਥੇ ਵੀ ਕਦੇ ਵੀ ਕੋਈ ਫੰਕਸ਼ਨ ਹੁੰਦਾ ਹੈ ਤਾਂ ਮੇਰੇ ਪੈਰ ਰੁਕਦੇ ਨਹੀਂ ਗਾਣਾ ਸੁਣ ਕੇ ਆਪਣੇ ਆਪ ਥਿਰਕਣ ਲੱਗ ਜਾਂਦੇ ਹਨ ਡਾਂਸ ਉਂਝ ਵੀ ਪੰਜਾਬੀਆਂ ਦੀ ਜਾਨ ਹੈ ਉਹਨਾਂ ਦੀ ਅੰਦਰ ਵਸਿਆ ਹੋਇਆ ਹੈਗਾ ਜਦੋਂ ਵੀ ਕਿਤੇ ਵੀ ਕੋਈ ਵੀ ਫੰਕਸ਼ਨ ਹੁੰਦਾ ਤਾਂ ਗਾਣੇ ਸੁਣਦੇ ਹੀ ਉਹਨਾਂ ਦੇ ਪੈਰ ਨੱਚਣ ਲੱਗ ਜਾਂਦੇ ਹਨ ਇਸ ਲਈ ਇਹ ਡਾਂਸ ਮੈਨੂੰ ਵੀ ਬਹੁਤ ਪਸੰਦ ਹੈ